ਮੈਨੂੰ ਬਚਪਨ ਤੋਂ ਹੀ ਦੌੜਨਾ ਬਹੁਤ ਹੀ ਵਧੀਆ ਲੱਗਦਾ ਹੈ ਦੌੜਨਾ ਮੈਨੂੰ ਬਹੁਤ ਪਸੰਦ ਹੈ ਇੱਦਾਂ ਹੀ ਇੱਕ ਟਾਇਮ ਦੌੜ ਦੇ ਵਿੱਚ ਹਿੱਸਾ ਮੈਂ ਵੀ ਹਿੱਸਾ ਲਿਆ ਦੌੜ ਦੇ ਵਿੱਚ ਜਿਸ ਦੇ ਦੌਰਾਨ ਦੌੜਦ ਦੇ ਦੌੜਦੇ ਮੈਂ ਦੌੜਦੇ ਦੌੜਦੇ ਨਕੋਇਲੀ ਨੋਕੀਲੀ ਚੀਜ਼ ਮੇਰੇ ਪੈਰ ਦੇ ਵਿੱਚ ਵੱਜਣ ਕਾਰਨ ਮੇਰਾ ਪੈਰ ਮੁੜਿਆ ਜਿਸ ਦੇ ਵਿੱਚ ਮੈਨੂੰ ਕਾਫੀ ਇੰਜਰੀ ਕਾਫੀ ਦਰਦ ਅਤੇ ਕਾਫੀ ਦਰਦ ਦਾ ਸਾਹਮਣਾ ਕਰਨਾ ਪਿਆ ਪਰ ਮੈਂ ਹਿੰਮਤ ਨਹੀਂ ਹਾਰੀ ਉਸ ਨੂੰ ਪੂਰਾ ਕੀਤਾ ਉਸ ਦੌੜ ਨੂੰ ਮੈਂ ਪੂਰਾ ਕੀਤਾ ਇਸ ਦੇ ਦੌਰਾਨ ਸੱਟਾਂ ਤਾਂ ਲੱਗਦੀਆਂ ਹੀ ਰਹਿੰਦੀਆਂ ਹਨ ਪਰ ਪਰ ਆਪਣਾ ਖਿਆਲ ਰੱਖਣਾ ਵੀ ਚਾਹੀਦਾ ਹੈ ਇਸ ਕਰਕੇ ਉਸ ਉਸ ਦੌੜ ਨੂੰ ਪੂਰਾ ਕਰਨ ਤੋਂ ਬਾਅਦ ਮੈਂ ਆਪਣਾ ਇਲਾਜ ਕਰਵਾਇਆ ਅਤੇ ਜੋ ਕਿ ਮੈਨੂੰ ਕਾਫੀ ਦਰਦ ਵੀ ਹੋਈ ਬਟ ਹੌਲੀ ਹੌਲੀ ਆਰਾਮ ਆਇਆ